ਹਾਂਜੀ ਸਾਡੇ ਤਾਂ ਵੈਸੇ ਤਾਂ ਕੰਮ ਖੇਤੀ ਦਾ ਕੰਮ ਆ ਬਹੁਤ ਵਧੀਆ ਕੰਮ ਆ ਵੀ ਕਿਸਾਨ ਖੇਤੀ ਬੀਜਦੇ ਸੀਗੇ ਫਸਲਾਂ ਬੀਜਦੇ ਸੀ ਗੰਨਾ ਬੀਜਣਾ ਕਣਕ ਬੀਜਣੀ ਮੱਕੀ ਬੀਜਣੀ ਅਤੇ ਝੋਨਾ ਬੀਜਣਾ ਬਹੁਤ ਵੀ ਗ ਗ ਗੰਨੇ ਤੋਂ ਸਾਨੂੰ ਗੁੜ ਵੀ ਮਿਲ ਜਾਂਦਾ ਸ਼ੱਕਰ ਵੀ ਮਿਲ ਜਾਂਦੀ ਖੰਡ ਵੀ ਮਿਲ ਜਾਂਦੀ ਆ ਫਿਰ ਝੋਨਾ ਸਾਡਾ ਵਰਤ ਨਹੀਂ ਹੁੰਦਾ ਅਸੀਂ ਚੌਲ ਘੱਟ ਵਰਤਦੇ ਹਾਂ ਅਤੇ ਅਸੀਂ ਬਾਹਰਲੇ ਦੇਸ਼ਾਂ ਨੂੰ ਦੇਈਦਾ ਵਾ ਫਿਰ ਉਧਰੋਂ ਸਾਡੇ ਮੱਕੀ ਦੀ ਰੋਟੀ ਬਣ ਜਾਂਦੀ ਆ ਕਣਕ ਦੀ ਰੋਟੀ ਬਣ ਜਾਂਦੀ ਆ ਪਰ ਜੇ ਝੋਨਾ ਬੀਜਣਾ ਸਾਡਾ ਪਾਣੀ ਦਾ ਬਹੁਤ ਘੱਟ ਹੁੰਦਾ ਵਾ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਆ ਪਾਣੀ ਕਿੰਨਾ ਹੀ ਘੱਟ ਗਿਆ ਵਾ ਵੀ ਇੰਨਾ ਪਾਣੀ ਨਹੀਂ ਹੈਗਾ ਜਿਦਾਂ ਹੁਣ ਬਾਹਰਲੇ ਦੇਸ਼ ਜਿਦਾਂ ਰਾਜਸਥਾਨ ਕਹਿੰਦਾ ਸਾਨੂੰ ਪਾਣੀ ਦਿਓ ਦਿੱਲੀ ਕਹਿੰਦੀ ਸਾਨੂੰ ਪਾਣੀ ਦਿਓ ਸਾਰੇ ਸ ਹਿਮਾਚਲ ਕਹਿੰਦਾ ਸਾਨੂੰ ਪਾਣੀ ਦਿਓ ਫਿਰ ਇੱਦਾਂ ਨਾ ਵੀ ਹੁਣ ਪੰਜਾਬ ਦੇ 'ਚ ਪਾਣੀ ਦੰਦਾ ਹੀ ਨਹੀਂ ਹੈਗਾ ਫਿਰ ਕੀ ਬੰਦਾ ਕਵੇ ਅਤੇ ਫਿਰ ਉਹ ਬ ਹੁਣ ਵੀ ਸ ਵੈਸੇ ਵੀ ਸਰਕਾਰ ਜਿਹੜੇ ਕਿਸਾਨ ਵਾ ਉਹ ਵੀ ਕ ਕਰਜਿਆਂ ਦੇ ਡਰਦੇ ਹੋਏ ਵੀ ਜਦ ਕੋਈ ਕੁੜੀ ਦਾ ਵਿਆਹ ਕਰਨਾ ਤਾਂ ਵੀ ਕਰਜਾ ਚੁੱਕ ਲੈਣਾ ਜਾਂ ਟਰੈਕਟਰ ਲੈਣਾ ਤਾਂ ਵੀ ਕਰਜਾ ਚੁੱਕਣਾ ਸਾਰਾ ਕੁਝ ਕਰਜਿਆਂ ਦਾ ਦੱਬੇ ਹੋਏ ਸੀ ਜਾ ਕਿਸੇ ਬੱਚੇ ਨੂੰ ਬਾਹਰ ਭੇਜਣਾ ਤਾਂ ਵੀ ਕਰਜਾ ਲੈਣਾ ਨਵੇਸ਼ਹਿਰ ਤਾਂ ਏਦਾਂ ਹੀ ਆ ਦੋ ਚਾਰ ਘਰਾਂ ਦੇ ਬਾਅਦ ਬਾਹਰ ਜਾਂਦੇ ਬਾਹਰ ਜਾਂਦੇ ਬਾਹਰ ਜਾਂਦੇ ਜੇ ਕਹੀਏ ਨੌਕਰੀਆਂ ਅਤੇ ਪੰਜਾਬ 'ਚ ਤਾਂ ਨੌਕਰੀਆਂ ਕੋਈ ਹੈ ਹੀ ਨਹੀਂ ਫਿਰ ਬਾਹਰ ਜਾ ਕੇ ਨੌਕਰੀਆਂ ਦਾ ਸਰਦਾ ਵਾ ਤਾਂ ਕਰਕੇ ਏ ਹਾਲ ਆ ਠੀਕ ਹੈ